ਕੁਝ ਅਜਿਹੇ ਵਿਸ਼ੇ ਹਨ ਜਿਹਨਾਂ ਬਾਰੇ ਮੈਂ ਲਿਖਣਾ ਤਾਂ ਚਾਹੁੰਦਾ ਹਾਂ ਪਰ ਮੈਂ ਸ਼ੱਕੀ ਜਿਹਾ ਹਾਂ ਕਿਉਂਕਿ ਮੈਨੂੰ ਕੋਈ ਸੇਧ ਨਹੀਂ ਮਿਲ ਰਹੀ ਉਦਾਹਰਣ ਦੇ ਤੌਰ 'ਤੇ ਅੰਗਰੇਜ਼ੀ ਵਿਸ਼ਾ ਮੇਰੇ ਲਈ ਸ਼ੱਕੀ ਹੈ ਕਿਉਂਕਿ ਇਸਦੇ ਵਿੱਚ ਕਈ ਵਾਰੀ ਇਹੋ ਜਿਹੀਆਂ ਤਰੁੱਟੀਆਂ ਹਨ ਗ੍ਰਾਮੈਟੀਕਲ ਮਿਸਟੇਕ ਹਨ ਜੋ ਕਿ ਅਸੀਂ ਆਮ ਨਹੀਂ ਸਮਝ ਸਕਦੇ ਇਸ ਕਰਕੇ ਬੋਲਣ ਦੇ ਵਿੱਚ ਜਾਂ ਸਮਝਣ ਦੇ ਵਿੱਚ ਕੁਛ ਨਾ ਕੁਛ ਸਾਨੂੰ ਮੁਸੀਬਤ ਕਿਆ ਹੈ ਆਉਂਦੀ ਹੈ